ਭਾਰਤ ਵਿੱਚ ਭੋਜਨ ਭ ਭਾਰਤ ਵਿੱਚ ਭੋਜਨ ਅਲੱਗ ਅਲੱਗ ਅਲੱਗ ਅਲੱਗ ਸਟੇਟਾਂ ਦਾ ਅਲੱਗ ਅਲੱਗ ਭੋਜਨ ਹੈ ਅਤੇ ਇਹਦੇ ਵਿੱਚ ਪੰਜਾਬ ਅਤੇ ਹੋਰ ਸਟੇਟਾਂ ਜਿੱਦਾਂ ਮਤਲਬ ਯੂ ਪੀ ਬਿਹਾਰ ਕੁੱਲ ਉਣੱਤੀ ਸਟੇਟਾਂ ਹਨ ਪੰਜਾਬ ਭਾਰਤ ਵਿੱਚ ਅਤੇ ਇਹਨਾਂ ਦੇ ਅਲੱਗ ਅਲੱਗ ਖਾਣੇ ਹਨ ਅਲੱਗ ਅਲੱਗ ਕਲਚਰ ਹਨ ਜੀ ਪੰਜਾਬ ਵਿੱਚ ਜਿੱਦਾਂ ਮੰਨ ਲਓ ਜੀ ਮੱਕੀ ਰੋਟੀ ਹੈ ਸਾਗ ਸੂਗ ਜੀ ਕਣਕ ਜ਼ਿਆਦੇ ਖਾਂਦੇ ਆ ਲੋਕ ਉਸੇ ਤਰ੍ਹਾਂ ਵੈਸਟ ਬੰਗਾਲ ਹੋ ਗਿਆ ਸਾਊਥ ਵਿੱਚ ਜ਼ਿਆਦੇ ਚੋਲਾਂ ਦੇ ਵਰਤੋਂ ਕੀਤੀ ਜਾਂਦੀ ਹੈ ਲੋਕਾਂ ਦੁਆਰਾ ਅਲੱਗ ਅਲੱਗ ਸਟੇਟਾਂ ਦੇ ਅਲੱਗ ਅਲੱਗ ਮਸਾਲਾਂ ਹੈ ਅਤੇ ਲੋਕ ਅਲੱਗ ਅਲੱਗ ਜਣੀ ਕਿ ਖਾਦੇ ਹਨ ਅਲੱਗ ਅਲੱਗ ਖੇਤੀ ਬੀਜੀ ਜਾਂ ਬੀਜੀ ਜਾਂਦੀ ਹੈ ਅਤੇ ਅਲੱਗ ਅਲੱਗ ਜਣੀ ਕਲਚਰ ਹੈ ਕਈ ਜਗ੍ਹਾ ਨ ਕਈ ਸਟੇਟਾਂ 'ਚ ਲੋਕ ਨੋਨ ਵੇਜੀਟਲ ਖਾਂਦੇ ਹਨ ਕਈ ਕਈ ਜਗ੍ਹਾ ਵੇਜੀਟਲ ਖਾਂਦੇ ਹਨ ਕਈ ਤਰ੍ਹਾਂ ਦੇ ਲੋਕ ਹਨ ਜੋ ਅਲੱਗ ਅਲੱਗ ਤਰ੍ਹਾਂ ਦੇ ਪਕਵਾਨ ਖਾਂਦੇ ਹਨ ਹਰੇਕ ਸਟੇਟ ਦਾ ਅਲੱਗ ਅਲੱਗ ਪਕਵਾਨ ਹੈ ਜਿੱਦਾਂ ਜਿੱਦਾਂ ਜੂ ਪੀ ਵਿੱਚ ਅਲੱਗ ਜਾਣੀ ਲੱਗ ਤਰ੍ਹਾਂ ਦੀ ਹੈ ਬਾਜਰੇ ਦੀ ਵੀ ਬਾਜਰੇ ਦੀ ਫਸਲ ਨਾਲ ਬਾਜਰੇ ਦੀ ਰੋਟੀ ਬਣਦੀ ਉੱਥੇ ਕਣਕ ਦੀ ਰੋਟੀ ਬਣਦੀ ਹੈ ਅਤੇ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੀ ਦਾਲਾਂ ਸਬਜ਼ੀਆਂ ਬਣਦੀਆਂ ਹਨ ਅਤੇ ਪੰਜਾਬ ਵਿੱਚ ਵੀ ਜਿੱਦਾਂ ਕਣਕ ਮੱਕੀ ਦੀ ਰੋਟੀ ਅਤੇ ਕੁਛ ਚਾਵਲ ਦਾ ਵੀ ਚਾਵਲ ਦੀ ਵੀ ਵਰਤੋਂ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਹਿਮਾਚਲ ਹੋ ਗਿਆ ਹਿਮਾਚਲ ਦੇ ਵਿੱਚ ਜ਼ਿਆਦੇ ਚਾਵਲ ਦੀ ਵਰਤੋਂ ਕੀਤੀ ਜਾਂਦੀ ਹੈ ਕੁਝ ਮੱਕੀ ਅਤੇ ਕਣਕ ਅਤੇ ਹੋਰ ਅਲੱਗ ਅਲੱਗ ਪਕਵਾਨ ਹਨ ਸਾਊਥ ਵਿੱਚ ਅਲੱਗ ਅਲੱਗ ਤਰ੍ਹਾਂ ਦੇ ਪਕਵਾਨ ਹਨ ਅਤੇ ਹਰੇਕ ਸਟੇਟ ਦਾ ਆਪਣਾ ਅਲੱਗ ਅਲੱਗ ਪਕਵਾਨ ਹੈ ਮਹਾਰਾਸ਼ਟਰ ਵਿੱਚ ਜ਼ਿਆਦੇ ਬਾਜਰੇ ਅਤੇ ਮੱਕੀ ਦੀ ਰੋਟੀ ਦੀ ਬਹੁਤ ਜ਼ਿਆਦਾ ਵਰਤੋਂ ਹੁੰਦੀ ਹੈ ਅਤੇ ਕਣਕ ਬਹੁਤ ਘੱਟ ਜਣੀ ਚੋਲ ਦੀ ਜ਼ਿਆਦਾ ਜ਼ਿਆਦਾ ਵਰਤੋਂ ਹੁੰਦੀ ਹੈ ਅਲੱਗ ਅਲੱਗ ਸਟੇਟਸ ਦੀ ਅਲੱਗ ਅਲੱਗ ਵਰਤੋਂ ਹੈ ਅਤੇ ਬੈਸਟ ਬੰਗਾਲ ਪਹਿਲਾਂ ਜ਼ਿਆਦਾ ਝੋਨੇ ਦੀ ਵਰਤੋਂ ਹੁੰਦੀ ਹੈ ਉੱਥੇ ਝੋਨਾ ਜ਼ਿਆਦਾ ਉਗਾਇਆ ਜਾਂਦਾ ਹੈ ਇਸ ਕਰਕੇ ਉੱਥੇ ਝੋਨੇ ਮਸਾਲਿਆਂ ਦੀ ਕਾਫ਼ੀ ਪੈਦਾਵਾਰ ਹੁੰਦੀ ਹੈ ਹਰੇਕ ਹਰੇਕ ਸਟੇਟ ਦਾ ਅਲੱਗ ਅਲੱਗ ਆਪਣਾ ਪਕਵਾਨ ਹਨ ਅਤੇ ਅਲੱਗ ਅਲੱਗ ਕੈਟਾਗਰੀ ਹਨ